ਹੈਲੋ ਵੀਰੇ ਸਤਿ ਸ਼੍ਰੀ ਅਕਾਲ ਤੁਸੀਂ ਸੰਧੂ ਟ੍ਰਾਂਸਪੋਰਟ ਤੋਂ ਬੋਲਦੇ ਹੋ ਮੈਂ ਨਾ ਤੁਹਾਡੇ ਇੱਥੇ ਕੈਬ ਬੁੱਕ ਕਰਵਾਈ ਸੀਗੀ ਅਤੇ ਉਹ ਕੈਬ ਦੇ ਵਿੱਚ ਨਾ ਮੇਰਾ ਕੱਲ ਸਮਾਨ ਰਹਿ ਗਿਆ ਥੋੜ੍ਹਾ ਜਿਹਾ ਜ਼ਰੂਰੀ ਹੈਗਾ ਉਹ ਕਾਗਜ਼ ਪੱਤਰ ਜਿਹੜੇ ਹੈਗੇ ਉਹ ਜ਼ਰੂਰੀ ਹੈਗੇ ਅਤੇ ਇੱਕ ਮੇਰਾ ਪਰਸ ਰਹਿ ਗਿਆ ਉਹਦੇ ਵਿੱਚ ਉਹਦੇ ਵਿੱਚ ਵੀ ਪੈਸੇ ਸੀਗੇ ਅਤੇ ਮੈਂ ਨਾ ਕੱਲ੍ਹ ਕਾਹਲੀ ਕਾਹਲੀ ਦੇ ਵਿੱਚ ਉਤਰ ਗਈ ਮੈਨੂੰ ਜ਼ਰੂਰੀ ਕੋਈ ਕੰਮ ਸੀਗਾ ਤਾਂ ਹੀ ਮੈਂ ਕਾਹਲੀ ਕਾਹਲੀ 'ਚ ਉਤਰ ਕੇ ਉਹ ਪਰਸ ਭੁੱਲ ਗਈ ਉੱਥੇ ਅਤੇ ਜਾਂ ਤਾਂ ਮੈਨੂੰ ਵੀ ਉਹ ਟੈਕਸੀ ਡਰਾਈਵਰ ਜਿਹੜਾ ਕੈਬ ਵਾਲਾ ਗਾ ਉਹਦਾ ਮੈਨੂੰ ਜਾਂ ਨੰਬਰ ਦੇ ਦਿਓ ਮੈਂ ਵੀ ਫੋਨ ਕਰਕੇ ਕਹਿ ਦੂੰਗੀ ਵੀ ਆਹ ਡਰੈਸ 'ਤੇ ਭੇਜ ਦਿਓ ਅਤੇ ਜਾਂ ਫਿਰ ਵੀ ਆਹ ਵਾਲੇ ਐਡਰੈਸ 'ਤੇ ਤਾਂ ਮੇਰੇ ਸਮਾਨ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਹੈਗੀ ਅਤੇ ਜਾਂ ਫਿਰ ਤੁਸੀਂ ਹੀ ਉਹਨੂੰ ਫੋਨ ਕਰਕੇ ਕਹਿ ਦਿਓ ਕਿ ਮੈਂ ਇਸ ਐਡਰੈਸ 'ਤੇ ਵੀ ਪਹੁੰਚਾ ਦੂੰਗਾ ਸਮਾਨ ਅਤੇ ਵੀਰ ਕਿਰਪਾ ਕਰਕੇ ਮੇਰੀ ਬਸ ਇਹ ਬੇਨਤੀ ਕਰ ਜਦ ਮੇਰੇ ਬਹੁਤ ਜ਼ਰੂਰੀ ਕਾਗਜ਼ ਹੈਗੇ ਉਹ ਕਾਗਜ਼ ਬਿਨਾਂ ਤਾਂ ਉਹ ਹੈ ਕਿ ਮੈਂ ਭੁੱਲ ਗਈ ਜੇ ਮੈਂ ਨਾ ਭੁੱਲਦੀ ਮੈਨੂੰ ਜ਼ਰੂਰੀ ਕੰਮ ਨਾ ਹੁੰਦਾ ਫਿਰ ਤਾਂ ਮੇਰੇ ਯਾਦ ਹੀ ਸੀਗੇ ਮੈਂ ਕਾਹਲੀ ਕਾਹਲੀ ਦੇ ਵਿੱਚ ਭੁੱਲ ਗਈ ਉਹ ਸਮਾਨ ਕਿਰਪਾ ਕਰਕੇ ਤਾਂ ਮੇਰਾ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਮੇਰੇ ਕੋਲ ਕਿਉਂਕਿ ਮੇਰੇ ਬਹੁਤ ਜ਼ਰੂਰੀ ਕਾਗਜ਼ ਨੇ ਉਹ ਨਹੀਂ ਤਾਂ ਜੇ ਤੁਹਾਨੂੰ ਕੋਈ ਉਹ ਟੈਕਸੀ ਡਰਾਈਵਰ ਨਹੀਂ ਮਿਲਦਾ ਕੈ ਕੈਬ ਵਾਲਾ ਤਾਂ ਮੈਨੂੰ ਉਹਦਾ ਨੰਬਰ ਦੇਣ ਦੀ ਕਿਰਪਾਲਤਾ ਕਰਨੀ ਮੈਂ ਉਸ ਨਾਲ ਆਪੇ ਗੱਲ ਕਰ ਲੂੰਗੀ ਕਿਉਂਕਿ ਫਿਰ ਮੈਂ ਉਸ ਨੂੰ ਕਹਿ ਦੂੰਗੀ ਕਿ ਮੈਨੂੰ ਜਲਦੀ ਤੋਂ ਜਲਦੀ ਹੀ ਮੈਨੂੰ ਜਲਦੀ ਤੋਂ ਜਲਦੀ ਹੀ ਵੀ ਉਹ ਜ਼ਰੂਰੀ ਕਾਗਜ਼ ਆ ਅਤੇ ਮੇਰੇ ਅਤੇ ਕਾਗਜ਼ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਠੀਕ ਹੈ